ਨਿਊਜ਼ ਮੀਡੀਆ ਯੂ ਪੀ ਐੱਸ ਸੀ ਆਰ ਦੀ ਪ੍ਰੀਖਿਆ ਦੇਣੀਆਂ ਇਗਜ਼ਾਮ ਦੇਣਾ ਹੁੰਦਾ ਉਹਨਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਮਦਦ ਕਰਦਾ ਹੈ ਕਿਉਂਕਿ ਇਹਦੇ ਵਿੱਚ ਮਤਲਬ ਆਲੇ ਦੁਆਲੇ ਦੀਆਂ ਜਿਹੜੀ ਮਤਲਬ ਡੇਲੀ ਰੂਟੀਨ ਹੁੰਦੀ ਆ ਉਹ ਵੀ ਕਿੱਥੇ ਕੀ ਹੋਇਆ ਕਿੱਥੇ ਕੀ ਹੋਇਆ ਸੰਨ ਵਗੈਰਾ ਮਤਲਬ ਜੋ ਕਿ ਆਲੇ ਦੁਆਲੇ ਦੀਆਂ ਕਰੰਟ ਘਟਨਾਵਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਉਹਨਾਂ ਨੂੰ ਯਾਦ ਰੱਖਣਾ ਸਾਨੂੰ ਇਹ ਨਿਊਜ਼ ਮੀਡੀਆ ਰਾਹੀਂ ਬਹੁਤ ਸੌਖਾ ਹੁੰਦਾ ਉਹ ਸਾਡੇ ਡੇਲੀ ਦੇ ਡੇਲੀ ਮਤਲਬ ਯਾਦ ਰਹਿੰਦੀਆਂ ਨੇ ਵੀ ਫਲਾਣੀ ਜਗ੍ਹਾ 'ਤੇ ਸਾਡੇ ਕੋਈ ਇਹ ਕਾਂਡ ਹੋਇਆ ਕੰਮ ਹੋਇਆ ਕੋਈ ਘਟਨਾਵਾਂ ਹੋਈ ਆ ਕੋਈ ਚੋਰੀ ਹੋਈ ਆ ਕੋਈ ਇੰਨੇ ਸੰਨ ਵਿੱਚ ਇੰਨਾ ਹੋਇਆ ਸੀਗਾ ਤਾਂ ਉਹ ਸਾਨੂੰ ਯਾਦ ਰੱਖਣੀਆਂ ਬਹੁਤ ਜ਼ਿਆਦਾ ਸੌਖੀਆਂ ਹੁੰਦੀਆਂ ਹਨ ਇਸ ਯੂ ਪੀ ਐੱਸ ਸੀ ਆਰ ਦੇ ਵਿੱਚ ਵੀ ਆਲੇ ਦੁਆਲੇ ਦੀ ਮਤਲਬ ਨਿਊਜ਼ ਮੀਡੀਆ ਰਾਹੀਂ ਜੋ ਆਪਣੇ ਆਲੇ ਦੁਆਲੇ ਘਟਨਾਵਾਂ ਵਾਪਰਦੀਆਂ ਨੇ ਹੁੰਦੀਆਂ ਨੇ ਉਹ ਵੀ ਉ ਉਹਦੇ ਰਿਲੇਟਿਵ ਵੀ ਕੌਸਚਨ ਪੁੱਛੇ ਜਾਂਦੇ ਹਨ ਅਤੇ ਉਸਦੇ ਪੇਪਰ ਵਿੱਚ ਤਾਂ ਕਰਕੇ ਇਹ ਨਿਊਜ਼ ਮੀਡੀਆ ਜਿਹੜਾ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਸਾਨੂੰ ਮਤਲਬ ਕਿ ਬੁੱਕਸ ਖੋਲ੍ਹ ਕੇ ਉਹਨਾਂ ਨੂੰ ਰੀਡ ਕਰਨਾ ਨਹੀਂ ਪੈਂਦਾ ਤਾਂ ਆਲੇ ਦੁਆਲੇ ਦੀਆਂ ਗੱਲਾਂ ਇਹੋ ਜਿਹੀ ਵੀ ਇਨਫੋਰਮੇਸ਼ਨ ਆ ਸਾਨੂੰ ਮਿਲ ਜਾਂਦੀ ਹੈ ਤਾਂ ਉਹੀ ਸਾਨੂੰ ਯਾਦ ਕਰਨ ਵਿੱਚ ਆਸਾਨੀ ਹੁੰਦੀ ਹੈ ਅਤੇ ਏ ਇਸ ਕਰਕੇ ਸਭ ਇਗਜ਼ਾਮ ਲਈ ਇਹ ਸਾਡੇ ਲਈ ਨਿਊਜ਼ ਮੀਡੀਆ ਬਹੁਤ ਹੀ ਬੈਨੀਫਿੱਟ ਹੈ ਅਤੇ ਸਾਨੂੰ ਇਸ ਦੀ ਗੱਲਾਂ ਮਤਲਬ ਨਿਊਜ਼ ਮੀਡੀਆ ਰਾਹੀਂ ਸੁਣ ਕੇ ਆਸਾਨੀ ਨਾਲ ਯਾਦ ਵੀ ਹੋ ਜਾਂਦੀਆਂ ਨੇ ਸਾਡਾ ਟਾਈਮ ਵੀ ਬਹੁਤ ਜ਼ਿਆਦਾ ਘੱਟ ਲੱਗਦਾ ਹੈ ਇਸ ਕਰਕੇ ਇਹ ਨਿਊਜ਼ ਮੀਡੀਆ ਵਿਦਿਆਰਥੀਆਂ ਲਈ ਬਹੁਤ ਹੀ ਮਦਦ ਕਰਦੇ ਹੈ